ਕੁਝ ਭਾਰਤੀ ਕਲਾ ਸ਼ੈਲੀਆਂ ਜੋ ਕਿ ਬਹੁਤ ਚਰਚਾ ਦਾ ਵਿਸ਼ਾ ਬਣ ਗਈਆਂ ਹਨ ਜਿਵੇਂ ਕਿ ਅੱਜ ਕੱਲ੍ਹ ਕਲਯੁੱਗ ਦਾ ਦੌਰ ਹੈ ਅਤੇ ਤੁਹਾਨੂੰ ਪਤਾ ਹੀ ਆ ਲੋਕ ਪਿੰਡਾਂ ਨੂੰ ਛੱਡ ਕੇ ਸ਼ਹਿਰਾਂ ਵੱਲ ਭੱਜਦੇ ਨੇ ਅਤੇ ਆਪਣੀਆਂ ਤਕਨੀਕੀ ਯੁੱਗ ਵੱਧ ਗਿਆ ਏ ਅਤੇ ਕੁਝ ਵਿਰਾਸਤੀ ਚੀਜ਼ਾਂ ਵੀ ਆਪਣੀਆਂ ਅਲੋਪ ਹੋ ਰਹੀਆਂ ਏ ਸ਼ਹਿਰਾਂ ਵਿੱਚ ਰੁਝਾਨ ਵੱਧਣ ਕਰਕੇ ਲੋਕ ਪਿੰਡਾਂ ਦੇ ਸੱਭਿਆਚਾਰ ਨੂੰ ਅਣਗੌਲਿਆ ਕਰਕੇ ਸ਼ਹਿਰਾਂ ਵਿੱਚ ਵਸਣ ਕਰਕੇ ਉੱਥੋਂ ਦਾ ਰਹਿਣ ਸਹਿਣ ਪਸੰਦ ਕਰਦੇ ਨੇ ਕਿਉਂਕਿ ਸਾਡੀ ਆਉਣ ਵਾਲੀ ਪੀੜ੍ਹੀ ਲਈ ਕੁਛ ਬਚਣਾ ਨਹੀਂ ਜੇ ਆਪਾਂ ਸਾਰੇ ਇੱਧਰ ਪੰਜਾਬ 'ਚੋਂ ਜਾਂ ਪਿੰਡਾਂ ਚੋਂ ਆਪਣਾ ਪੁਰਾਣਾ ਸੱਭਿਆਚਾਰ ਭੁੱਲ ਕੇ ਹੋਰ ਆਪਣੀਆਂ ਪੁਰਾਣੇ ਰੀਤੀ ਰਿਵਾਜ਼ ਪ੍ਰੰਪਰਾਵਾਂ ਆਪਾਂ ਉਹਨਾਂ ਨੂੰ ਅਣਗੌਲਿਆ ਕਰਾਂਗੇ ਤਾਂ ਸਾਡੇ ਆਉਣ ਵਾਲਿਆਂ ਲਈ ਤਾਂ ਕੁਝ ਬਚਣਾ ਹੀ ਨਹੀਂ ਜਿਸ ਕਰਕੇ ਸਾਨੂੰ ਇਹ ਚੀਜ਼ਾਂ ਵੱਲ ਧਿਆਨ ਦੇਣ ਦੀ ਲੋੜ ਆ